ਹਾਂ ਮੈਂ ਘਰ ਵਿੱਚ ਤੁਲਸੀ ਅਤੇ ਹੋਰ ਜੜੀ ਬੂਟੀਆਂ ਵਰਗੇ ਪੌਦੇ ਉਗਾਉਂਦਾ ਹਾਂ ਜਿਹਨਾਂ ਵਿੱਚ ਨੀਮ ਦਾ ਪੇੜ ਜਿਸ ਦੇ ਨਾਲ ਖੂਨ ਸਾਫ਼ ਹੁੰਦਾ ਹੈ ਔਰ ਪੁਦੀਨਾ ਘਰ ਵਿੱਚ ਆਮ ਹੀ ਲਗਾਇਆ ਜਾਂਦਾ ਹੈ ਜਿਸ ਨਾਲ ਪੇਟ ਸਾਫ਼ ਹੁੰਦਾ ਹੈ ਐਲੋ ਵੀਰਾ ਦਾ ਇਸਤੇਮਾਲ ਕਰਦੇ ਹਾਂ ਜੋ ਕਿ ਸਰੀਰ ਵਾਸਤੇ ਖੂਨ ਸਾਫ਼ ਕਰਨ ਵਾਸਤੇ ਮਦਦ ਕਰਦਾ ਹੈ ਇਸ ਤੋਂ ਬਿਨਾਂ ਪੱਥਰ ਚੱਟ ਘਰ ਵਿੱਚ ਆਮ ਲਗਾਇਆ ਜਾਂਦਾ ਹੈ ਜੋ ਕਿ ਸੱਟ ਲੱਗਣ 'ਤੇ ਠੀਕ ਕਰਨ ਵਿੱਚ ਮਦਦ ਕਰਦਾ ਹੈ ਹਾਂ ਮੈਨੂੰ ਲੱਗਦਾ ਹੈ ਕਿ ਇਹ ਐਂਟੀਬੈਟਿਕਸ ਨਾਲੋਂ ਬਿਹਤਰ ਹੈ